ਹਲੇ ਤਾਂਈ ਮੇਰੀ ਕੋਈ ਵੀ ਬੀਮਾ ਕਵਰੇਜ ਨਹੀਂ ਹੋਈ ਹੈ ਇਸ ਤੋਂ ਇਸ ਪ੍ਰਕਾਰ ਮੈਨੂੰ ਕਿਸੇ ਵੀ ਬੀਮਾ ਕਵਰੇਜ 'ਚ ਤੋਂ ਕੋਈ ਫਰਕ ਨਹੀਂ ਪੈ ਰਿਹਾ ਪਰ ਸਾਡੇ ਹਸਪਤਾਲਾਂ ਖੇਤਰ ਅਤੇ ਹਸਪਤਾਲਾਂ ਵਿੱਚ ਬੀਮੇ ਦੇ ਪ੍ਰਬੰਧਨ ਦਾ ਬਹੁਤ ਹੀ ਮਾੜਾ ਹਾਲ ਹੈ ਇਹ ਬਹੁਤ ਹੀ ਨਿਰਵਿਘਨ ਹੈ ਨਿਰ ਨਿਰਵਿਘਨ ਹਾਲਾਤਾਂ ਵਿਚ ਮੌਜੂ ਮੌਜੂਦ ਹੈ ਇਸ ਤੋਂ ਸਿਵਾ ਸਰਕਾਰ ਤੋਂ ਸਾਨੂੰ ਕੋਈ ਮਦਦ ਸਹਾਇਤਾ ਨਹੀਂ ਮਿਲਦੀ ਹੈ ਉੱਥੇ ਬੀਮਾ ਸਹਾਇਤਾ ਦਾ ਬਹੁਤ ਹੀ ਮਾੜਾ ਪ੍ਰਬੰਧ ਹੈ ਅਤੇ ਕਈ ਲੋਕਾਂ ਨੂੰ ਉਸ ਨਾਲ ਦੇਣ ਜਾਣੂ ਨਹੀਂ ਕਰਵਾਇਆ ਜਾਂਦਾ ਹੈ ਅਤੇ ਜਿਨਾਂ ਲੋਕਾਂ ਕੋਲ ਜਾਣਕਾਰੀ ਹੈ ਉਹਨਾਂ ਲੋਕਾਂ ਲਈ ਵੀ ਪੱਖ ਨਹੀਂ ਸੁਣਿਆ ਜਾਂਦਾ